ਮੈਂ ਨਵਾਂਸ਼ਹਿਰ ਪਿੰਡ ਵਿੱਚ ਰਹਿੰਦੀ ਹਾਂ ਸਾਡੇ ਪਿੰਡ ਵਿੱਚ ਪਹਿਲਾਂ ਤੋਂ ਬਹੁਤ ਜ਼ਿਆਦਾ ਬਦਲਾਅ ਹੋ ਗਿਆ ਹੈ ਸਾ ਸਾਡੇ ਪਿੰਡ ਵਿੱਚ ਪਹਿਲਾਂ ਕੁੜੀਆਂ ਪੜ੍ਹਨ ਨਹੀਂ ਜਾਂਦੀਆਂ ਸੀ ਪਹਿਲਾਂ ਘਰ ਤੋਂ ਬਾਹਰ ਨਹੀਂ ਜਾਂਦੀਆ ਸੀ ਹੁਣ ਤਾਂ ਉਹ ਘਰ ਤੋਂ ਬਾਹਰ ਵੀ ਜਾਂਦੀਆਂ ਹੈ ਅਤੇ ਕੰਮ ਵੀ ਕਰਦੀਆਂ ਹੈ ਅਤੇ ਪੜ੍ਹਦੀਆਂ ਵੀ ਚੰਗੀਆਂ ਅਤੇ ਸਾ ਅਤੇ ਉਹਨਾਂ ਦੇ ਮਾਂ ਬਾਪ ਹੀ ਪਹਿਲੇ ਪੜ੍ਹਾਉਂਦੇ ਨਹੀਂ ਤੇ ਨਾ ਪੈਸੇ ਦੇ ਕਰਕੇ ਹੁਣ ਤਾਂ ਨੌਕਰੀਆਂ ਵੀ ਹੈਗੀਆਂ ਅਤੇ ਪੜ੍ਹਾਉਂਦੇ ਵੀ ਵਧੀਆ ਹੈ ਅਤੇ ਸ ਕੁੜੀਆ ਪੜ੍ਹ ਵੀ ਪੜ੍ਹਦੀਆਂ ਵੀ ਬਹੁਤ ਹੈ ਅਤੇ ਆਪਣੇ ਆਪਣੇ ਪੈਰਾਂ 'ਤੇ ਵੀ ਖੜ੍ਹਾ ਖੜ੍ਹੀ ਹੋ ਗਈਆ ਹੈ ਅਤੇ ਉਹ ਜਿਵੇਂ ਜੌਬ ਕਰਦੀਆਂ ਹੈ ਕਿਤੇ ਮ ਹੋਸਪੀਟਲ 'ਚ ਹੈ ਕਿਤੇ ਮਤਲਬ ਮਤਲਬ ਕੰਪਨੀ 'ਚ ਮੈਨੇਜਰ ਹੈ ਇੰਨਜੀਨਰ ਹੈਗੀਆਂ ਨੇ ਅਤੇ ਸਾਡੇ ਪਿੰਡ ਵਿੱਚ ਇਹ ਬਹੁਤ ਹੀ ਵਧੀਆ ਕੰਮ ਹੋ ਰਿਹਾ ਹੈ ਪਹਿਲਾਂ ਤੋਂ ਨਾਲ ਤਾਂ ਬਹੁਤ ਵਧੀਆ ਹੋ ਗਿਆ ਤੋਂ ਇਹ ਸਾਰਾ ਕੁਛ ਮੈਂ ਵੀ ਬਹੁਤ ਖੁਸ਼ ਹਾਂ ਕਿ ਸਾਡਾ ਪਿੰਡ ਇੰਨਾ ਤਰੱਕੀ ਕਰ ਰਿਹਾ ਹੈ ਅਤੇ ਪਿੰਡ ਵਾਲੇ ਵੀ ਬਹੁਤ ਖੁਸ਼ ਹੁੰਦੇ ਹੈ ਕਿ ਸਾਡਾ ਪਿੰਡ ਇੰਨਾ ਤਰੱਕੀ ਕਰਨ ਲੱਗ ਗਿਆ ਹੈ